ਮੇਰਾ ਮਨਪਸੰਦ ਵਿਸ਼ਾ ਸਕੂਲ ਵਿੱਚ ਸਾਹਿਤ ਹੁੰਦਾ ਸੀ ਕਿਉਂਕਿ ਮੈਨੂੰ ਕਹਾਣੀਆਂ ਪੜ੍ਹਨਾ ਬਹੁਤ ਪਸੰਦ ਸੀ ਇੱਕ ਵੱਡੇ ਪੁਸਤਕਾਲਿਆ ਵਿੱਚ ਕਿਤਾਬਾਂ ਦੀ ਖੋਜ ਮੇਰੇ ਲਈ ਇੱਕ ਆਨੰਦ ਸੀ ਇਕ ਖੁਸ਼ੀ ਦਾ ਦਿਨ ਯਾਦ ਹੈ ਜਦੋਂ ਮੇਰੇ ਸਕੂਲ ਦਾ ਗੁਰੂ ਮੇਰੇ ਮੇਰੇ ਨੂੰ ਉਹਨਾਂ ਦੀ ਖੁਸ਼ਬੂ ਵਾਲੀ ਪੁਸਤਕ ਦਾ ਪ੍ਰਸਤਾਵ ਕੀਤਾ ਉਹ ਮੇਰੇ ਵਿਚਾਰਾਂ ਨੂੰ ਪ੍ਰੇਰਿਤ ਕਰਦੀ ਸੀ ਅਤੇ ਮੈਨੂੰ ਸਾਹਿਤਕ ਸੰਸਾਰ ਵਿੱਚੋਂ ਦੋਖ ਹੁੰਦੀ ਦੋਗ ਦਿੰਦੀ ਸੀ ਮੇਰੇ ਸਕੂਲ ਦੇ ਦਿਨਾਂ ਵਿੱਚ ਇੱਕ ਖੁਸ਼ੀ ਦੀ ਯਾਦ ਹੈ ਜਦੋਂ ਮੇਰੇ ਅਧਿਆਪਕ ਨੇ ਸਾਰੇ ਵਿਦਿਆਰਥੀਆਂ ਨੂੰ ਦਿਵਾਲੀ ਦੇ ਅਫਤਰ ਅਵਸਰ 'ਤੇ ਪੁਸਤਕ ਦਾ ਅਵਾਰਡ ਦਿੱਤਾ ਸੀ ਇਹ ਮੋਮੈਂਟ ਹਮੇਸ਼ਾਂ ਮੇਰੇ ਦਿਲ ਵਿੱਚ ਸਵੇਰ ਦੀ ਸੁਨਹਿਰੀ ਚਿੰਦੀ ਬਣੀ ਰਹੇਗਾ ਇਹ ਮੋਮੈਂਟ ਸਭ ਕੁਛ ਵਿੱਚ ਇਹ ਖੁਸ਼ੀ ਦੀ ਸੁਨਹਿਰੀ ਲਈ ਮੰਨਿਆ ਜਾਂਦਾ ਹੈ